ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਜੀ ਕਿਆ ਹਾਲ ਚਾਲ ਹੈ ਜੀ ਗੁਨੋਵ ਕਮਨੀਕੇਸ਼ਨ ਤੋਂ ਬੋਲਦੇ ਭਾਅ ਜੀ ਭਾਅ ਜੀ ਮੈਂ ਨਾ ਤੁਹਾਡੇ ਉਹ ਤੋਂ ਸ਼ੋਪ ਤੋਂ ਹਫ਼ਤਾ ਪਹਿਲਾਂ ਮੋਬਾਈਲ ਔਡਰ ਕੀਤਾ ਸੀਗਾ ਜੀ ਇੱਕ ਤਾਂ ਭਾਅ ਜੀ ਓਹਦੀ ਡਿਲੀਵਰੀ ਬੜੀ ਟਾਈਮ ਨਾਲ ਮਿਲੀ ਹੈਗੀ ਹੈ ਜੀ ਮੈਨੂੰ ਫ਼ੋਨ ਵੀ ਬੜਾ ਵਧੀਆ ਸੀਗਾ ਜੀ ਵਧੀਆ ਉਹਦੀ ਪੈਕਿੰਗ ਵਗੈਰਾ ਕਾਫੀ ਅੱਛੀ ਸੀਗੀ ਜੀ ਉਹਦੀ ਉਹਦਾ ਜਦ ਮੈਂ ਭਾਅ ਜੀ ਉਹਨੂੰ ਚਲਾ ਕੇ ਦੇਖਿਆ ਤਾਂ ਉਹਦੀ ਪ੍ਰੋਸੈਸਿੰਗ ਸਿਸਟਮ ਕੈਮਰਾਜ ਵਗੈਰਾ ਉਹ ਵੀ ਕਾਫੀ ਵਧੀਆ ਸੀਗੇ ਜੀ ਉਹਦੇ ਉਹਦੇ ਸਪੀਕਰ ਵਗੈਰਾ ਵੀ ਉਹਦੇ ਕਾਫੀ ਅੱਛੇ ਸੀਗੇ ਜੀ ਉਹਦੇ ਉਹਦਾ ਭਾਅ ਜੀ ਹੋਰ ਵੀ ਜੇ ਆਪਾਂ ਸਿਸਟਮ ਦੇਖਿਆ ਜਾਵੇ ਜਿਹੜੀ ਉਹਦੀ ਕੈਮਰਾ ਕੁਆਲਿਟੀ ਅਤੇ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਫੀਚਰ ਸੀਗੇ ਉਹਦੇ ਓਹ ਕਾਫੀ ਕਾਫੀ ਜਿਹੜੇ ਉਹਨਾਂ ਦੇ ਉਹ ਸੀਗੇ ਉਹ ਮ ਕਾਫੀ ਹੋਰ ਮੋਬਾਈਲਾਂ ਦੇ ਕੰਪੈਰੀਜ਼ਨ ਕੀਤਾ ਜਾਵੇ ਉਹਨਾਂ ਦੇ ਅਕੋਡਿੰਗ ਕਾਫੀ ਉਹਦੇ ਅੱਛੇ ਵਧੀਆ ਸੀਗੇ ਜੀ ਉਹਦੇ ਉਹਦੇ ਵੀਹ ਪੁਆਇੰਟ ਵੀ ਕਾਫੀ ਸੀਗਾ ਭਾਅ ਜੀ ਭਾਅ ਜੀ ਇੱਦਾਂ ਦਾ ਹੋਰ ਕੋਈ ਮੋਬਾਈਲ ਵੀ ਹੋਇਆ ਤਾਂ ਮੈਨੂੰ ਜ਼ਰੂਰ ਦੱਸਿਓ ਮੈਂ ਵੀ ਉਹ ਉਹ ਵੀ ਲੈਣਾ ਚਾਹੂੰਗਾ ਭਾਅ ਜੀ ਮੈਂ ਧੰਨਵਾਦ ਭਾਅ ਜੀ